ਹਾਂਜੀ ਅਸੀਂ ਆਪਣੀ ਕਿਤਾਬ ਨੂੰ ਆਮ ਤੌਰ 'ਤੇ ਪੂਰਾ ਕਰਨ ਦੇ ਲਈ ਦਸ ਦਿਨ ਵੀਹ ਦਿਨ ਅਤੇ ਕਈ ਕਈ ਵਾਰ ਇੱਕ ਮਹੀਨੇ ਦਾ ਟਾਈਮ ਵੀ ਲੱਗ ਜਾਂਦਾ ਹੈ ਮੈਂ ਸਿੱਧਾ ਪੜ੍ਹਨ ਦੇ ਲਈ ਮੈਨੂੰ ਦੋ ਘੰਟੇ ਲਗਭਗ ਲੱਗ ਜਾਂਦੇ ਹਨ ਉਸ ਤੋਂ ਬਾਅਦ ਥੋੜ੍ਹੀ ਥਕਾਵਟ ਫੀਲ ਕਰਦੇ ਹਾਂ ਅਤੇ ਪੜ੍ਹਨ ਦੇ ਲਈ ਮ ਜਿਹੜਾ ਹਫਤਾਵਾਰੀ ਟੀਚਾ ਹੈ ਜਿਵੇਂ ਮਈ ਜੂਨ ਦੀਆਂ ਛੁੱਟੀਆਂ ਹੁੰਦੀਆਂ ਨੇ ਅਸੀਂ ਉਸ ਦੇ ਵਿੱਚ ਪੜ੍ਹ ਸਕਦੇ ਹਾਂ